ਮੇਰੀ ਮਨ ਪਸੰਦ ਕਵਿਤਾ ਕਵਿਤਾ ਅਪਸਰਾ ਹੈ ਜਿਸ ਦਾ ਮੇਰੀ ਮਨਪਸੰਦ ਕਿਤਾਬ ਅਪਸਰਾ ਹੈ ਜਿਸ ਵਿੱਚ ਬਹੁਤ ਸਾਰੀਆਂ ਕਵਿਤਾਵਾਂ ਲਿਖੀਆਂ ਗਈਆਂ ਹਨ ਉਹਨਾਂ ਕਵਿਤਾਵਾਂ ਵਿੱਚ ਉਹਨਾਂ ਕਵਿਤਾਵਾਂ ਵਿੱਚੋਂ ਮੈਨੂੰ ਮੇਰੀ ਮਨ ਪਸੰਦ ਕਵਿਤਾ ਰੂਹਾਂ ਰੂਹਾਂ ਦੀਆਂ ਗੱਲਾਂ ਹੈ ਜਿਸ ਤੋਂ ਮੈਨੂੰ ਪ੍ਰੇਰਣਾ ਮਿਲਦੀ ਹੈ ਕਿ ਸਾਨੂੰ ਕਿਸੇ ਵੀ ਨਾ ਕਿਸੇ ਨਾਲ ਵੀ ਜਿਸਮ ਨਾਲ ਨਹੀਂ ਸਗੋਂ ਰੂਹ ਨਾਲ ਪਿਆਰ ਕਰਨਾ ਚਾਹੀਦਾ ਹੈ ਸਗੋਂ ਰੂਹ ਨਾਲ ਜੁੜਨਾ ਚਾਹੀਦਾ ਹੈ ਅਤੇ ਰੂਹਾਂ ਨਾਲ ਰੂਹ ਨਾਲ ਗੱਲਾਂ ਕਰਨੀਆਂ ਚਾਹੀਦੀਆਂ ਹਨ ਇਹ ਕਵਿਤਾ ਮੇਰੀ ਬਹੁਤ ਮਨ ਪਸੰਦ ਹੈ ਇਹ ਕਵਿਤਾ ਕਿਤਾਬ ਅਪਸਰਾ ਵਿੱਚੋਂ ਲਈ ਗਈ ਹੈ ਅਤੇ ਮੇਰੀ ਮਨਪਸੰਦ ਕਵੀਤਾ ਹੈ ਮੈਨੂੰ ਆਮ ਤੌਰ 'ਤੇ ਇੰਗਲਿਸ਼ ਵਿੱਚ ਲਿਖਣਾ ਵਧੀਆ ਲੱਗਦਾ ਹੈ